ਅੱਜ ਕੱਲ੍ਹ ਦੇ ਬੱਚੇ ਜਿਸ ਤਰ੍ਹਾਂ ਸਿਰਫ ਕਿਤਾਬੀ ਪੜ੍ਹਾਈ ਨੂੰ ਹੀ ਅਹਿਮੀਅਤ ਦਿੰਦੇ ਹਨ ਤਾਂ ਸਰਕਾਰ ਦਾ ਧਿਆਨ ਇਸ ਚੀਜ਼ ਵੱਲ ਹੈ ਕਿ ਖੇਡਾਂ ਦੇ ਉਦਯੋਗ ਅਤੇ ਖੇਡਾਂ ਨੂੰ ਕਿਸ ਤਰ੍ਹਾਂ ਪ੍ਰੋਤਸਾਹਿਤ ਕੀਤਾ ਜਾਵੇ ਸਰਕਾਰ ਆਪਣੇ ਸਰਕਾਰੀ ਅਤੇ ਗੈਰ ਸਰਕਾਰੀ ਸੰਸਥਾਵਾਂ ਦੇ ਵਿੱਚ ਖੇਡਾਂ ਨੂੰ ਮਹੱਤਵਪੂਰਨ ਸਥਾਨ ਦੇ ਰਹੀ ਹੈ ਜਿਸ ਤਰ੍ਹਾਂ ਕਿ ਉਹ ਹਰ ਜਗ੍ਹਾਂ 'ਤੇ ਗਵਰਮੈਂਟ ਜਾਂ ਨੋਨ ਗਵਰਮੈਂਟ ਸੰਸਥਾ ਦੇ ਵਿੱਚ ਸਪੋਰਟਸ ਕੋਟਾ ਰੱਖਦੀ ਹੈ ਸਪੋਰਟਸ ਕੋਟਾ ਤੋਂ ਭਾਵ ਹੁੰਦਾ ਹੈ ਕਿ ਜਿਹੜੇ ਬੱਚੇ ਖੇਡਾਂ ਦੇ ਵਿੱਚ ਬਹੁਤ ਅੱਛੇ ਹਨ ਵਧੀਆ ਤੋਂ ਵਧੀਆ ਇੰਸਟੀ ਇੰਸਟੀਟਊਸ਼ਨਸ ਦੇ ਵਿੱਚ ਵੀ ਉਹਨਾਂ ਨੂੰ ਪਹਿਲ ਦਿੱਤੀ ਜਾਂਦੀ ਹੈ ਕਿ ਉਹ ਉਹ ਘੱਟ ਨੰਬਰਾਂ 'ਤੇ ਰਹਿ ਕੇ ਲੇਕਿਨ ਆਪਣੀ ਪਰਫੋਰਮੈਂਸ ਖੇਡਾਂ ਦੇ ਵਿੱਚ ਅੱਛੀ ਤੋਂ ਅੱਛੀ ਕਰਕੇ ਇਹ ਉਹਨਾਂ ਇੰਸਟੀਟਿਊਸ਼ਨਸ ਦੇ ਵਿੱਚ ਐਡਮਿਸ਼ਨ ਲੈ ਸਕਦੇ ਹਨ ਸਰਕਾਰ ਸਪੋਰਟਸ ਕੋਟੇ ਤੋਂ ਬਾਅਦ ਫਿਰ ਜੋਬਸ ਦੀ ਅਵੇਲੇਬਿਲਟੀ ਦੇ ਵਿੱਚ ਵੀ ਇਹ ਉਹਨਾਂ ਦੀ ਦੀ ਇੱਕ ਰਾਖਵਾਂਕਰਨ ਰੱਖਦੀ ਹੈ ਸਰਕਾਰੀ ਨੌਕਰੀਆਂ ਦੇ ਵਿੱਚ ਰਾਖਵਾਂਕਰਨ ਉਹਨਾਂ ਨੂੰ ਉਹਨਾਂ ਦੀਆਂ ਪਦਵੀਆਂ 'ਤੇ ਉੱਨਤੀਆਂ ਵੀ ਪ੍ਰੋਵਾਈਡ ਕਰਦਾ ਹੈ